ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਮੈਂ ਇੱਕ ਆਪਣਾ ਤਜਰਬਾ ਤੁਹਾਡੇ ਨਾਲ਼ ਸਾਂਝਾ ਕਰਨਾ ਚਾਹੁੰਦੀ ਹਾਂ ਇੱਕ ਵਾਰ ਦੀ ਗੱਲ ਹੈ ਕਿ ਮੇਰੇ ਬੇਟੇ ਦਾ ਬਰਡੇ ਸੀ ਅਤੇ ਕਾਫ਼ੀ ਲੋਕਾਂ ਦੇ ਕਾਫੀ ਜੀ ਮਹਿਮਾਨ ਆ ਗਏ ਅਤੇ ਇਸ ਕਰਕੇ ਮੈਨੂੰ ਕੋਈ ਕੰਮ ਕਰਨ ਵਾਸਤੇ ਕੋਈ ਵੀ ਕਿਸੇ ਤਰ੍ਹਾਂ ਦੀ ਹੈਲਪ ਵਾਸਤੇ ਕੋਈ ਮੇਡ ਵੀ ਕੁਝ ਨਹੀਂ ਮਿਲ ਰਿਹਾ ਸੀ ਇਸ ਕਰਕੇ ਮੈਂ ਸਾਰਾ ਕੰਮ ਖੁਦ ਕੀਤਾ ਜਿਸ ਦਾ ਕਾਫ਼ੀ ਮਹਿਮਾਨ ਹੋਣ ਕਰਕੇ ਇਸ ਕਰਕੇ ਮੈਂ ਖਾਰਾ ਸਾਰਾ ਖਾਣਾ ਖੁਦ ਬਣਾਇਆ ਜਿਹਦੇ ਵਿੱਚ ਮੈਂ ਮਟਰ ਪਨੀਰ ਬਣਾਇਆ ਚੌਲ ਰਾਇਤਾ ਬਣਾਇਆ ਚੌਲ ਬਣਾਏ ਨਾਲ਼ ਫੁਲਕੇ ਬਣਾਏ ਪੂੜੀਆਂ ਬਣਾਈਆਂ ਨਾਲ਼ ਸ਼ਾਹੀ ਪਨੀਰ ਦੀ ਸਬਜ਼ੀ ਬਣਾਈ ਉਹਦੇ ਨਾਲ ਸਲਾਦ ਉਹਦੇ ਵਿੱਚ ਮਿੱਠੇ ਵਿੱਚ ਮੈਂ ਦੁੱਧ ਵਾਲੀਆਂ ਸੇਵੀਆਂ ਦੀ ਸੇਵੀਆਂ ਬਣਵਾਈਆਂ ਬਣਾਈਆਂ ਜੇ ਪਹਿਲਾਂ ਸਭ ਤੋਂ ਪਹਿਲਾਂ ਮੈਂ ਆਟਾ ਗੁੰਨ ਕੇ ਇੱਕ ਸਾਈਡ 'ਤੇ ਰੱਖ ਲਿਆ ਉਸ ਤੋਂ ਬਾਅਦ ਮੈਂ ਪਿਆਜ਼ ਲਸਣ ਸਭ ਕੁਝ ਚੀਰ ਲਿਆ ਇੱਕ ਪਾਸੇ ਤੇਲ ਗਰਮ ਹੋਣ ਵਾਸਤੇ ਰੱਖ ਲਿਆ ਸਭ ਤੋਂ ਪਹਿਲਾਂ ਤੇਲ ਤੇਲ ਵਿੱਚ ਜੀਰੇ ਦਾ ਅਤੇ ਅਜਵਾਇਣ ਦਾ ਤੜਕਾ ਪਾਇਆ ਉਹਦੇ ਵਿੱਚ ਬਾਅਦ ਉਸ ਤੋਂ ਬਾਅਦ ਉਹਦੇ ਵਿੱਚ ਲਸਨ ਅਤੇ ਅਦਰਕ ਦਾ ਪੇਸਟ ਪਾ ਕੇ ਫਿਰ ਉਹਨੂੰ ਥੋੜ੍ਹਾ ਜਿਹਾ ਫਰਾਈ ਕੀਤਾ ਉਸ ਤੋਂ ਬਾਅਦ ਪਿਆਜ਼ ਨੂੰ ਫਰਾਈ ਕੀਤਾ ਥੋੜ੍ਹਾ ਜਿਹਾ ਫਿਰ ਉਹਦੇ ਵਿੱਚ ਹਲਦੀ ਨਮਕ ਮਸਾਲਾ ਪਾਇਆ ਉਸ ਤੋਂ ਬਾਅਦ ਮੈਂ ਉਹਨੂੰ ਥੋੜ੍ਹਾ ਜਿਹਾ ਫਰਾਈ ਕਰਕੇ ਫਿਰ ਮਿਰਚਾਂ ਅਤੇ ਟਮਾਟਰ ਦਾ ਪੇਸਟ ਪਾ ਦਿੱਤਾ ਜਦੋਂ ਥੋੜ੍ਹੇ ਜਿਹੇ ਫਰਾਈ ਹੋ ਗਏ ਦੇਗੀ ਮਿਰਚ ਕਲਰ ਵਾਸਤੇ ਪਾਈ ਜਦੋਂ ਥੋੜ੍ਹੇ ਜਿਹੇ ਫਰਾਈ ਹੋ ਗਏ ਉਹਦੇ ਵਿੱਚ ਮੈਂ ਮਟਰ ਪਾਏ ਮਟਰ ਪਾ ਕੇ ਥੋੜ੍ਹਾ ਜਿਹਾ ਪਾਣੀ ਪਾ ਕੇ ਥੋੜ੍ਹਾ ਜਿਹਾ ਉਹਨੂੰ ਮੈਸ਼ ਕਰਨ ਵਾਸਤੇ ਰੱਖ ਦਿੱਤਾ ਦਸ ਪੰਦਰਾਂ ਮਿੰਟ ਵਿੱਚ ਮਿੰਟ ਵਾਸਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਇੱਕ ਵਿਸਲ ਵਜਾਈ ਵਿਸਲ ਵਜਾ ਕੇ ਉਹਨੂੰ ਖੋਲ ਲਿਆ ਖੋਲ ਕੇ ਉਹਦੇ ਵਿੱਚ ਮੈਂ ਛੋਟੇ ਛੋਟੇ ਮਟਰਾਂ ਪਨੀਰ ਦੇ ਪੀਸ ਕਰਕੇ ਵਿੱਚ ਪਾ ਦਿੱਤੇ ਇਸ ਤਰ੍ਹਾਂ ਮੈਂ ਪੰਦਰਾਂ ਪੰਦਰਾਂ ਕੁ ਮਿੰਟ ਦੋ ਕੁ ਵਿਸਲਾਂ ਹੋਰ ਵਜਾਈਆਂ ਅਤੇ ਮੇਰੇ ਮਟਰ ਪਨੀਰ ਦੀ ਸਬਜ਼ੀ ਰੈਡੀ ਹੋ ਗਈ ਉਸ ਤੋਂ ਬਾਅਦ ਮੈਂ ਰਾਏਤ ਚੌਲ ਬਣਾਉਣ ਵਾਸਤੇ ਚੌਲਾਂ ਵਾਸਤੇ ਮੈਂ ਪਹਿਲਾਂ ਜੀਰੇ ਦਾ ਤੜਕਾ ਲਾਇਆ ਤੇਲ ਰੱਖਿਆ ਤੇਲ ਨੂੰ ਜੀਰੇ ਦਾ ਤੜਕਾ ਲਾਇਆ ਉਹਦੇ ਵਿੱਚ ਪਿਆਜ਼ ਪਾਏ ਪਿਆਜ਼ ਪਾ ਕੇ ਮਸਾਲੇ ਪਾ ਕੇ ਉਹਦੇ ਵਿੱਚ ਉਹਨੂੰ ਥੋੜ੍ਹਾ ਜਿਹਾ ਫਰਾਈ ਕੀਤਾ ਉਸ ਤੋਂ ਬਾਅਦ ਮਿਰਚ ਅਦਰਕ ਪਾ ਕੇ ਉਹਨੂੰ ਤਿਆਰ ਕਰ ਲਿਆ ਪੇ ਸਾਰੇ ਸਮਾਨ ਮਸਾਲੇ ਨੂੰ ਉਹਦੇ ਵਿੱਚ ਚੌਲ ਪਾ ਦਿੱਤੇ ਚੌਲ ਪਾ ਕੇ ਇੱਕ ਪਾਣੀ ਪਾ ਕੇ ਇੱਕ ਵਿਸਲ ਵਜਾਈ ਅਤੇ ਚੌਲ ਰੈਡੀ ਹੋ ਗਏ ਉਸ ਤੋਂ ਬਾਅਦ ਮੈਂ ਦਹੀਂ ਲਿਆ ਦਹੀ ਵਿੱਚ ਪਿਆਜ਼ ਟਮਾਟਰ ਮਿਰਚਾਂ ਚੀਰ ਕੇ ਵਿੱਚ ਥੋੜ੍ਹਾ ਜਿਹਾ ਦਹੀਂ ਬੂੰਦੀ ਪਾ ਕੇ ਦਹੀਂ ਦਾ ਰਾਇਤਾ ਤਿਆਰ ਕਰ ਲਿਆ ਉਸ ਤੋਂ ਬਾਅਦ ਮੈਂ ਜੋ ਆਟਾ ਗੁੰਨਿਆ ਸੀ ਉਹਦੇ ਨਾਲ਼ ਮੈਂ ਥੋੜ੍ਹੀਆਂ ਜਿਹੀਆਂ ਵੇਲ ਕੇ ਪੂੜੀਆਂ ਤੇਲ ਵਿੱਚ ਫਰਾਈ ਕਰਕੇ ਪੂੜੀਆਂ ਬਣਾਈਆਂ ਕੁਝ ਰੋਟੀ ਬਣਾਈ ਉਸ ਤੋਂ ਬਾਅਦ ਮੈਂ ਇੱਕ ਸ਼ਾਹੀ ਪਨੀਰ ਬਣਾਇਆ ਸ਼ਾਹੀ ਪਨੀਰ ਵਾਸਤੇ ਤੇਲ ਰੱਖਿਆ ਗਰਮ ਤੇਲ ਗਰਮ ਰੱਖ ਕੇ ਉਹਨੂੰ ਵੀ ਇਸ ਤਰ੍ਹਾਂ ਹੀ ਤੜਕਾ ਲਾਇਆ ਪਹਿਲਾਂ ਜੀਰੇ ਦਾ ਅਜੁਆਇਣ ਦਾ ਤੜਕਾ ਫਰਾਈ ਕਰਕੇ ਫਿਰ ਲਸਣ ਪਿਆਜ਼ ਪਾ ਕੇ ਵਿੱਚ ਥੋੜ੍ਹੀ ਜਿਹੀ ਮਲਾਈ ਪਾ ਕੇ ਪਨੀਰ ਦੇ ਪੀਸ ਨੂੰ ਛੋਟੇ ਛੋਟੇ ਕੱਟ ਲਿਆ ਉਹਨੂੰ ਕੱਟ ਕੇ ਫਿਰ ਉਸ 'ਚ ਮਸਾਲੇ ਪਾ ਕੇ ਉਹਨੂੰ ਫਰਾਈ ਕੀਤਾ ਅਤੇ ਪਨੀਰ ਨੂੰ ਫਿਰ ਉਹਦੇ ਵਿੱਚ ਥੋੜ੍ਹਾ ਜਿਹਾ ਦੁੱਧ ਐਡ ਕਰਕੇ ਸ਼ਾਹੀ ਪਨੀਰ ਬਣਾ ਲਿਆ ਸਵਾਦ ਵਾਸਤੇ ਸਜਾਵਟ ਵਾਸਤੇ ਥੋੜ੍ਹਾ ਜਿਹਾ ਧਨੀਆ ਪਾ ਦਿੱਤਾ ਉਸ ਤੋਂ ਬਾਅਦ ਮੈਂ ਥੋੜ੍ਹੀਆਂ ਜਿਹੇ ਫੁਲਕੇ ਬਣਾ ਕੇ ਇੱਕ ਸਾਈਡ 'ਤੇ ਰੱਖ ਕੇ ਉਹਤੋਂ ਬਾਅਦ ਮੈਂ ਸਰਵ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਸਾਰੇ ਮਹਿਮਾਨਾਂ ਨੇ ਖਾ ਖਾ ਕੇ ਉਸ ਤੋਂ ਬਾਅਦ ਮੈਂ ਸੇਵੀਆਂ ਬਣਾਈਆਂ ਸੇਵੀਆਂ ਵਿੱਚ ਦੁੱਧ ਪਹਿਲਾਂ ਦੁੱਧ ਗਰਮ ਕਰਨ ਵਾਸਤੇ ਰੱਖਿਆ ਸੇਵੀਆਂ ਪਾਈਆਂ ਸੇਵੀਆਂ ਪਾ ਕੇ ਥੋੜ੍ਹਾ ਜਿਹਾ ਘਿਓ ਪਾ ਦਿੱਤਾ ਘਿਓ ਪਾ ਕੇ ਥੋੜ੍ਹੇ ਜਿਹੇ ਕ ਉਬਾਲਾ ਆਉਣ ਤੋਂ ਬਾਅਦ ਉਹਦੇ ਵਿੱਚ ਡਰਾਈ ਫਰੂਟ ਪਾ ਦਿੱਤਾ ਡਰਾਈ ਫਰੂਟ ਪਾ ਕੇ ਨਾਲ਼ ਹੀ ਮਿੱਠਾ ਪਾ ਕੇ ਰੋਟੀ ਤੋਂ ਬਾਅਦ ਉਹ ਖਾਣ ਵਾਸਤੇ ਦਿੱਤੀਆਂ ਜੋ ਕਿ ਸਾਰਿਆਂ ਮਹਿਮਾਨਾਂ ਨੇ ਬਹੁਤ ਪਸੰਦ ਕੀਤੀਆਂ ਮੈਨੂੰ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਖਾਣਾ ਖਵਾ ਕੇ